ਤੁਸੀਂ ਮੈਨੂੰ ਇੱਦਾਂ ਦੱਸੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਛ ਇੱਦਾਂ ਦਾ ਕਦੇ ਸਮ ਸਮਾਂ ਆਇਆ ਹੈ ਜੋ ਤੁਸੀਂ ਅੱਜ ਵੀ ਭੁੱਲਣਯੋਗ ਨਹੀਂ ਹੋ ਹਾਂਜੀ ਜਦੋਂ ਅਸੀਂ ਉੱਨੀ ਸੌ ਤਰਾਨਵੇਂ ਵਿੱਚ ਜਦੋਂ ਵਿਆਹ ਤੋਂ ਪਹਿਲਾਂ ਇਵੇਂ ਹੀ ਹੜ੍ਹ ਆਇਆ ਸੀ ਜਿ ਜਿਵੇਂ ਦੋ ਹਜ਼ਾਰ ਤੇਈ ਵਿੱਚ ਆਇਆ ਹੈ ਸਾਨੂੰ ਉਹ ਭੁੱਲ ਨਹੀਂ ਸਕਦਾ ਅਸੀਂ ਭੁੱਖਣ ਭਾਣੇ ਬੈਠੇ ਰਹੇ ਇਕ ਮਹੀਨਾ ਕੋਠੇ ਉੱਤੇ ਨਾ ਖਾਣ ਨੂੰ ਰੋਟੀ ਨਾ ਪ ਪੀਣ ਨੂੰ ਪਾਣੀ ਮਿਲਿਆ ਭੁੱਖੇ ਬੈਠੇ ਰਹੇ ਚੋਰ ਚੋਰੀਆਂ ਕਰਦੇ ਰਹੇ ਨਾ ਪੈ ਪਾਉਣ ਨੂੰ ਕੱਪੜਾ ਮਿਲਿਆ ਬਹੁਤ ਔਖਾ ਟਾਈਮ ਕੱਟਿਆ ਉਹ ਅਸੀਂ ਭੁੱਲ ਨਹੀਂ ਸਕਦੇ